ਹੈਲੋ ਸਰ ਸਤਿ ਸ਼੍ਰੀ ਅਕਾਲ ਮੈਂ ਜਗਦੀਸ਼ ਕੁਮਾਰੀ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਅਸੀਂ ਆਪਣੇ ਘਰ ਹੀ ਪੌਦਿਆਂ ਦੀ ਦੇਖਭਾਲ ਕਰਦੇ ਹਾਂ ਪੌਦੇ ਲਗਾਏ ਹੋਏ ਹਨ ਤੁਹਾਨੂੰ ਪਤਾ ਅੱਜ ਕੱਲ੍ਹ ਬਹੁਤ ਗਰਮੀ ਪੈ ਰਹੀ ਹੈ ਅਤੇ ਗਰੀਨ ਨੈਟ ਵੀ ਲਗਾਈ ਹੋਈ ਅਸੀਂ ਉਹਨਾਂ ਨਾਲ ਛਾਂ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੈ ਪੌਦੇ ਬਹੁਤ ਹੀ ਜ਼ਿਆਦਾ ਸੁੱਕ ਰਹੇ ਹਨ ਪਾਣੀ ਦੋ ਟਾਈਮ ਲਗਾਉਣ ਦੇ ਬਾਵਜੂਦ ਵੀ ਪੌਦੇ ਬੜੇ ਸੁੱਕਦੇ ਪਏ ਆ ਸਬਜ਼ੀਆਂ ਵੀ ਸੁੱਕਦੀਆਂ ਪਈਆਂ ਵਾ ਸਬਜ਼ੀਆਂ ਘਰ ਉਗਾਈਆਂ ਹਨ ਪਰ ਫਿਰ ਵੀ ਉਹਨਾਂ ਦਾ ਬਹੁਤ ਮਾੜਾ ਹਾਲ ਹੈ ਅੱਜ ਸਵੇਰੇ ਪਾਣੀ ਪਾਈਏ ਸ਼ਾਮਾਂ ਤੱਕ ਵੈਸੇ ਸੁੱਕ ਜਾਂਦਾ ਇਸ ਕਰਕੇ ਸਾਨੂੰ ਬਹੁਤ ਹੀ ਖਿਆਲ ਰੱਖਣਾ ਪੈਂਦਾ ਹੈ ਸਬਜ਼ੀਆਂ ਨੂੰ ਦੋ ਟਾਈਮ ਪਾਣੀ ਫੁੱਲਾਂ ਨੂੰ ਦੋ ਟਾਈਮ ਪਾਣੀ ਪੈਂਦਾ ਪਾਉਣਾ ਪਾਣੀ ਪਾਉਣਾ ਪੈਂਦਾ ਹੈ ਅਤੇ ਸਾਨੂੰ ਉਹਨਾਂ ਦਾ ਬਹੁਤ ਹੀ ਖਿਆਲ ਰੱਖਣਾ ਪੈਂਦਾ ਹੈ ਬਜ਼ਾਰ ਦੀ ਸਬਜ਼ੀ ਦਾ ਤਾਂ ਬਹੁਤ ਮਾੜਾ ਹਾਲ ਹੈ ਉਹਨਾਂ ਨੇ ਕਿੰਨੀਆਂ ਖਾਦਾਂ ਪਾਈਆਂ ਹੋਈਆਂ ਹਨ ਅਤੇ ਸਾਡੇ ਸਰੀਰ ਨੂੰ ਬਹੁਤ ਹੀ ਮਾੜੀਆਂ ਲੱਗਦੀਆਂ ਹਨ ਬੱਚਿਆਂ ਦਾ ਬੱਚਿਆਂ ਨੂੰ ਵੀ ਬਿਮਾਰੀਆਂ ਲੱਗਦੀਆਂ ਹਨ ਅਤੇ ਬੱਚੇ ਘਰ ਦੀ ਚੀਜ਼ ਹੀ ਪਸੰਦ ਕਰਦੇ ਹੈ ਇਸ ਕਰਕੇ ਮੈਂ ਸਾਰੀਆਂ ਸਬਜ਼ੀਆਂ ਘਰ ਹੀ ਉਗਾਈਆਂ ਦੋ ਟਾਈਮ ਉਹਨਾਂ ਨੂੰ ਪਾਣੀ ਦੇਈਦਾ ਬਹੁਤ ਮਾੜਾ ਹਾਲ ਹੈ ਗਰਮੀ ਦਾ ਗਰਮੀ ਕਰਕੇ ਸਾਰਾ ਕੁਛ ਸਾਰਾ ਕੁਝ ਦੇਖਣੇ ਪੈਂਦਾ ਸਾਰਾ ਕੁਝ ਹਿਸਾਬ ਨਾਲ ਹੀ ਦੋ ਟਾਈਮ ਪਾਣੀ ਪਾਉਣੇ ਪੈਂਦਾ